ਪੰਜਾਬੀ ਭਾਸ਼ਾ ਇੱਕ ਪੰਜਾਬ ਸੂਬੇ ਵਿੱਚ ਬੋਲੀ ਜਾਂਦੀ ਹੈ ਲਹਿੰਦੇ ਪੰਜਾਬ 'ਚ ਜੋ ਕਿ ਪਾਕਿਸਤਾਨ ਅਤੇ ਚੜ੍ਹਦੇ ਪੰਜਾਬ ਜੋ ਕਿ ਇੰਡੀਆ ਦੇ ਵਿੱਚ ਹੈ ਇਹਨਾਂ ਵਿੱਚੋਂ ਦੋਨਾਂ ਨੂੰ ਦੋਨਾਂ ਵਿੱਚ ਪੰਜਾਬੀ ਬੜੀ ਪ੍ਰਫੁੱਲਿਤ ਹੈ ਅਤੇ ਇਹਨੂੰ ਜਿਹੜੀ ਸੰਸਕ੍ਰਿਤ ਹੈ ਸੰਸਕ੍ਰਿਤ ਦੇ ਕਾਫੀ ਗੁਰਮੁਖੀ ਲਿਪੀ ਦੇ ਵਿੱਚ ਕਾਫੀ ਸ਼ਬਦ ਹੈਗੇ ਹੈ ਪਰ ਜਿਹੜੀ ਅੱਜ ਦੀ ਪੰਜਾਬੀ ਹੈ ਉਹ ਬੜੀ ਤਰੋੜ ਮਰੋੜ ਕੇ ਪੇਸ਼ ਕੀਤੀ ਜਾਂਦੀ ਹੈ ਤੋੜ ਮਰੋੜ ਕੇ ਲੋਕ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਅੰਗਰੇਜ਼ੀ ਅੰਗਰੇਜ਼ੀ ਨੂੰ ਬਹੁਤ ਜ਼ਿਆਦਾ ਪੰਜਾਬੀ ਦੇ ਵਿੱਚ ਯੂਜ਼ ਕੀਤਾ ਜਾਂਦਾ ਜਿਵੇਂ ਬ ਸ਼ੁੱਧ ਪੰਜਾਬੀ ਕੋਈ ਬੋਲਦਾ ਨਹੀਂ ਹੈਗਾ ਅਤੇ ਅੰਗਰੇਜ਼ੀ ਦੇ ਸ਼ਬਦ ਜਿਹੜੇ ਉਹ ਵਿੱਚ ਪੰਜਾਬੀ ਦੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਯੂਥ ਹੈ ਉਹ ਇਸਤੇਮਾਲ ਕਰਦਾ